ਸਭ ਤੋਂ ਵੱਧ ਵਿਦੇਸ਼ੀ ਸਮੱਗਰੀ ਅਸੀਂ ਇਜੀਨੋਮੋਟੋ ਵਰਤਦੇ ਹਨ ਉਹ ਅਸੀਂ ਗੋਭੀ ਵਿੱਚ ਪਾਉਂਦੇ ਹਨ ਗੋਭੀ ਬਣਾਉਣ ਵਿੱਚ ਅਸੀਂ ਪਹਿਲਾਂ ਅ ਆਪਣਾ ਪੰਜਾਬੀ ਮਸਾਲਾ ਤਿਆਰ ਕਰਦੇ ਹਨ ਜਿਹਦੇ ਵਿੱਚ ਪਿਆਜ਼ ਲਸਣ ਅਦਰਕ ਹੋਰ ਬਾਕੀ ਪੰਜਾਬੀ ਮਸਾਲੇ ਪਾ ਕੇ ਉਹਨੂੰ ਤਿਆਰ ਕਰਦੇ ਹਨ ਫਿਰ ਅਸੀਂ ਇਜੀਨੋਮੋਟੋ ਵੀ ਪਾਉਂਦੇ ਹਨ ਕਿਉਂਕਿ ਉਹ ਛੇਤੀ ਗਲ਼ ਜਾਣ 'ਤੇ ਉਹਦਾ ਸ ਟੇਸਟ ਵੀ ਅੱਛਾ ਬਣ ਜਾਣ ਸਾਨੂੰ ਖਾਣ ਵਿੱਚ ਬਹੁਤ ਵਧੀਆ ਲੱਗਦੀ ਹੈ ਇਜੀਨੋਮੋਟੋ ਦੀ ਅਸੀਂ ਵਰਤੋਂ ਕਰਦੇ ਹਨ ਗੋਭੀ ਵਿੱਚ